ਅੱਜ ਤੋਂ ਤਕਰੀਬਨ ਦੋ ਸਾਲ ਪਹਿਲਾਂ ਮੇਰੇ ਦਾਦਾ ਜੀ ਨੂੰ ਕਬਜ਼ ਦੀ ਪ੍ਰੋਬਲਮ ਹੋ ਗਈ ਸੀ ਜਿਹਦਾ ਅਸੀਂ ਬਹੁਤ ਜ਼ਿਆਦਾ ਐਲੋਪੈਥੀ ਇਲਾਜ ਕਰਵਾਇਆ ਵੱਡੇ ਤੋਂ ਵੱਡੇ ਡੋਕਟਰ ਨੂੰ ਦਿਖਾਇਆ ਪੀ ਜੀ ਆਈ ਏਮਸ ਤੱਕ ਦਿਖਾਇਆ ਕਿਉਂਕਿ ਉਹਨਾਂ ਦੀ ਇਹ ਪ੍ਰੋਬਲਮ ਜੋ ਸੀਗੀ ਕਾਫੀ ਸੀਰੀਅਸ ਸੀਗੀ ਸੋ ਉਹਨਾਂ ਨੂੰ ਜਿਸ ਵਜ੍ਹਾ ਕਰਕੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸੋ ਕਾਫੀ ਜ਼ਿਆਦਾ ਇਲਾਜ ਤੋਂ ਬਾਅਦ ਵੀ ਸਾਨੂੰ ਕੋਈ ਫਰਕ ਨਹੀਂ ਪਿਆ ਸੋ ਉਸ ਤੋਂ ਬਾਅਦ ਮੇਰੇ ਦਾਦਾ ਜੀ ਨੇ ਜੋ ਸਾਡੇ ਪਿੰਡ ਦੇ ਵਿੱਚ ਜੋ ਮਸ਼ਹੂਰ ਨੁਸਖੇ ਸਨ ਘਰੇਲੂ ਉਹਨਾਂ ਬਾਰੇ ਦੱਸਿਆ ਸਾਨੂੰ ਕਿ ਪੁਰਾਣੇ ਸਮੇਂ ਦੇ ਵਿੱਚ ਅਜਵੈਨ ਖਾ ਕੇ ਗਰਮ ਪਾਣੀ ਨਾਲ ਉਹਦੇ ਨਾਲ ਕਾਫੀ ਜ਼ਿਆਦਾ ਰਾਹਤ ਮਿਲਦੀ ਹੁੰਦੀ ਹੈ ਸੋ ਉਹਨਾਂ ਨੇ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਗਰਮ ਪਾਣੀ ਦੇ ਨਾਲ ਅਜਵੈਨ ਖਾਣੀ ਸ਼ੁਰੂ ਕੀਤੀ ਜਿਹਦੇ ਨਾਲ ਹੌਲੀ ਹੌਲੀ ਉਹਨਾਂ ਦੀ ਕਬਜ਼ ਦੀ ਪ੍ਰੋਬਲਮ ਦੇ ਵਿੱਚ ਉਹਨਾਂ ਨੂੰ ਸੁਧਾਰ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਅਦਰਕ ਦੇ ਨਾਲ ਕਾਲਾ ਲੂਣ ਖਾਣ ਦੇ ਨਾਲ ਵੀ ਕਾਫੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਕਬਜ਼ ਦੀ ਬਿਮਾਰੀ ਦੇ ਲਈ ਸੋ ਹੌਲੀ ਹੌਲੀ ਮੈਨੂੰ ਵੀ ਇਹਨਾਂ ਨੁਸਖਿਆਂ ਬਾਰੇ ਪਤਾ ਲੱਗਿਆ ਸੋ ਜਿਸ ਤੋਂ ਬਾਅਦ ਮੈਂ ਆਪਣੀ ਇੱਕ ਰਿਸਰਚ ਸ਼ੁਰੂ ਕੀਤੀ ਕਿਉਂਕਿ ਇਹ ਨੁਸਖੇ ਅਗਰ ਮੇਰੇ ਦਾਦਾ ਜੀ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਤਾਂ ਬਾਕੀ ਲੋਕਾਂ ਲਈ ਵੀ ਬਹੁਤ ਜ਼ਿਆਦਾ ਇਹ ਫਾਇਦਾ ਦੇ ਸਕਦੇ ਹਨ ਸੋ ਉਹਨਾਂ ਨੂੰ ਆਪਣੀ ਇਸ ਬਿਮਾਰੀ ਦਾ ਇੱਕ ਬਹੁਤ ਹੀ ਘਰੇਲੂ ਆਸਾਨ ਸਸਤਾ ਤਰੀਕਾ ਜੋ ਹੈ ਉਹ ਮਿਲ ਸਕਦਾ ਹੈ ਸੋ ਕਾਫੀ ਜ਼ਿਆਦਾ ਰਿਸਰਚ ਕਰਨ ਤੋਂ ਬਾਅਦ ਮੇਰੇ ਦਾਦਾ ਜੀ ਨੇ ਇਹ ਜਿੰਨੇ ਵੀ ਮੈਨੂੰ ਨੁਸਖੇ ਦੱਸੇ ਮੈਂ ਉਹਨਾਂ ਸਾਰੇ ਨੁਸਖਿਆਂ ਨੂੰ ਲਿਖਿਆ ਉਹਨਾਂ ਬਾਰੇ ਰਿਸਰਚ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਕੀ ਹੈ ਇੰਟਰਨੈੱਟ 'ਤੇ ਜਾ ਕੇ ਇੱਕ ਆਰਟੀਕਲ ਦੇ ਥਰੂ ਪਬਲਿਸ਼ ਵੀ ਕੀਤਾ ਸੀਗਾ ਜਿਸਦੇ ਨਾਲ ਮੈਨੂੰ ਬਹੁਤ ਜ਼ਿਆਦਾ ਪੋਜੀਟਿਵ ਰਿਵਿਊ ਵੀ ਮਿਲੇ ਲੋਕਾਂ ਨੇ ਕਾਫੀ ਸਾਰਿਆਂ ਨੇ ਕਮੈਂਟ ਕਰਕੇ ਦੱਸਿਆ ਕਿ ਇਹ ਜਿੰਨੇ ਵੀ ਨੁਸਖੇ ਹਨ ਤੁਸੀਂ ਦੱਸੇ ਉਸ ਕਿਤਾਬ ਦੇ ਵਿੱਚ ਲਿਖੇ ਉਸ ਆਰਟੀਕਲ 'ਚ ਪਬਲਿਸ਼ ਕੀਤੇ ਮੈਂ ਉਹਨਾਂ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਉਹਨਾਂ ਲੋਕਾਂ ਨੂੰ ਫਾਇਦਾ ਹੋਇਆ ਅਤੇ ਉਹਨਾਂ ਦੀ ਕਿੰਨੇ ਸਾਲਾਂ ਤੋਂ ਇਹ ਕਬਜ਼ ਦੀ ਜੋ ਬਿਮਾਰੀ ਸੀ ਉਹ ਠੀਕ ਹੋ ਗਈ ਸੋ ਮੇਰੇ ਪਿੰਡ ਦੇ ਵਿੱਚ ਜਿੰਨੇ ਵੀ ਇਹ ਨੁਸਖੇ ਪ੍ਰਚਲਿਤ ਸਨ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਜੋ ਵੀ ਚੀਜ਼ ਤੁਹਾਡੇ ਪਾਸ ਜੋ ਗਿਆਨ ਹੈ ਉਹਨੂੰ ਵੰਡ ਦੇਣਾ ਚਾਹੀਦਾ ਹੈ ਜਿਹਦੇ ਨਾਲ ਦੂਜਿਆਂ ਦਾ ਵੀ ਭਲਾ ਹੋਵੇ